ਹੈਲੋ ਹਾਂਜੀ ਮੈਮ ਕੀ ਮਦਦ ਕਰ ਸਕਦੀ ਮੈਂ ਤੁਹਾਡੀ ਠੀਕ ਹੈ ਮੈਮ ਹਾਂਜੀ ਮੈਮ ਤਿੰਨ ਤਿੰਨ ਦਿਨ ਮੈਮ ਬਹੁਤ ਘੱਟ ਵੀ ਨਹੀਂ ਹੈ ਬਹੁਤ ਵੱਧ ਵੀ ਨਹੀਂ ਹੈ ਤਿੰਨ ਦਿਨ ਓਕੇ ਆ ਅੰਮ੍ਰਿਤਸਰ ਘੁੰਮਣ ਵਾਸਤੇ ਸਾਡਾ ਜਿਹੜਾ ਟਰੈਵਲ ਗਾਈਡ ਹੈ ਉਹ ਤੁਹਾਡੇ ਨਾਲ ਚੌਵੀ ਘੰਟੇ ਰਹੇਗਾ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਸ਼ਹਿਰ 'ਚ ਕਿ ਕਿੱਧਰ ਜਾਣਾ ਕੀ ਕਰਨਾ ਕਿਸ ਤਰ੍ਹਾਂ ਕਰਨਾ ਉਹ ਅਸੀਂ ਤੁਹਾਨੂੰ ਸਾਰਾ ਗਾਈਡ ਕਰਾਂਗੇ ਅਤੇ ਤੁਹਾਨੂੰ ਸਾਰੇ ਗੁਰਦੁਆਰੇ ਵੀ ਘੁੰਮਾਂ ਦਾਂਗੇ ਗੋਲਡਨ ਟੈਂਪਲ ਦੁਰਗਿਆਣਾ ਟੈਂਪਲ ਅਤੇ ਗੋਬਿੰਦਗੜ੍ਹ ਫੋਰਟ ਜਲ੍ਹਿਆਂ ਵਾਲਾ ਬਾਗ ਸਭ ਕੁਛ ਕਵਰ ਹੋ ਜਾਏਗਾ ਵਾਹਗਾ ਬੋਡਰ ਦੀ ਵੀ ਤੁਹਾਨੂੰ ਪਰੇਡ ਵੀ ਦਿਖਾ ਕੇ ਲਿਆਵਾਂਗੇ ਤਾਂ ਤਿੰਨ ਦਿਨਾਂ 'ਚ ਹੋ ਜਾਏਗਾ ਬੜੇ ਆਰਾਮ ਨਾਲ ਹੋ ਜਾਏਗਾ ਠੀਕ ਹੈ ਮੈਮ ਮੈਂ ਕਰ ਲੂੰਗੀ ਕੋਈ ਕੋਈ ਚੱਕਰ ਨਹੀਂ ਓਕੇ ਓਕੇ